ਇੱਕ ਤਾਂ ਸਿਲੰਡਰ ਰਸੋਈ ਦੇ ਬਾਹਰ ਸੁਰੱਖਿਅਤ ਸਥਾਨ 'ਤੇ ਹੋਣਾ ਚਾਹੀਦਾ ਹੈ ਅਤੇ ਜਦੋਂ ਵੀ ਆਪਾਂ ਖਾਣਾ ਬਣਾਉਣ ਲਈ ਜਾਂਦੇ ਹਾਂ ਤਾਂ ਸਿਲੰਡਰ ਨੂੰ ਇੱਕ ਵਾਰੀ ਚੰਗੀ ਤਰ੍ਹਾਂ ਚੈੱਕ ਕਰ ਲਓ ਇਸ ਲਈ ਪਾਈਪ ਵਿੱਚ ਕੋਈ ਵੀ ਦਰਾਰ ਨਹੀਂ ਹੋਣੀ ਚਾਹੀਦੀ ਅਤੇ ਇਸ ਦਾ ਰੈਗੂਲੇਟਰ ਵੀ ਸਮੇਂ ਦੇ ਨਾਲ਼ ਚੈੱਕ ਕਰਦੇ ਰਹਿਣਾ ਚਾਹੀਦਾ ਹੈ